ਮੈਂ ਇਹ ਗੱਲ ਬਿਲਕੁਲ ਮੰਨਦਾ ਹਾਂ ਕਿ ਜ਼ਿਆਦਾ ਸਕਰੀਨ ਅਤੇ ਜ਼ਿਆਦਾ ਮੋਬਾਇਲ ਦੇਖਣ ਕਰਕੇ ਹੀ ਅੱਜ ਕੱਲ ਦੇ ਨੌਜਵਾਨ ਬੱਚੇ ਗੇਮਾਂ ਨਹੀਂ ਖੇਡਦੇ ਅਤੇ ਇਹ ਬਹੁਤ ਹੀ ਬੁਰੀ ਗੱਲ ਹੈ ਕਿਉਂਕਿ ਇਹ ਫੋਨ ਹੀ ਹਨ ਜੋ ਕਿ ਉਹਨਾਂ ਦੇ ਸਰੀਰ 'ਤੇ ਬਹੁਤ ਬੁਰਾ ਅਸਰ ਪਾਉਂਦੀਆਂ ਹਨ ਉਹ ਉਹਨਾਂ ਦੀਆਂ ਅੱਖਾਂ ਨੂੰ ਕਮਜ਼ੋਰ ਕਰ ਦਿੰਦੀਆਂ ਹਨ ਅਤੇ ਉਹ ਦਿਨੋ ਦਿਨ ਮੋਟੇ ਹੁੰਦੇ ਜਾਂਦੇ ਹਨ ਅਤੇ ਉਹਨਾਂ ਦੇ ਸਰੀਰ ਦੀ ਤੰਦਰੁਸਤੀ ਵੀ ਘੱਟਦੀ ਜਾਂਦੀ ਹੈ ਅੱਜ ਕੱਲ ਦੇ ਬੱਚਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਅਸਲੀ ਖੇਡਾਂ ਹਾ ਉਹ ਪਾਰਕ ਅਤੇ ਗਰਾਊਂਡ 'ਤੇ ਖੇਡੀਆਂ ਜਾਂਦੀਆਂ ਹਨ ਨਾ ਕਿ ਫੋਨ ਉੱਤੇ ਅਤੇ ਸਮੇਂ ਆ ਚੁੱਕਿਆ ਹੈ ਕਿ ਅੱਜ ਕੱਲ ਦੇ ਬੱਚੇ ਇਹ ਗੱਲ ਸਮਝਣ ਕਿ ਜੋ ਤੰਦਰੁਸਤੀ ਉਹਨਾਂ ਨੂੰ ਕ੍ਰਿਕਟ ਹਾਕੀ ਫੁੱਟਬਾਲ ਖੇਡ ਕੇ ਮਿਲ ਸਕਦੀ ਹੈ ਉਹ ਫੋਨ ਰਾਹੀਂ ਕਦੇ ਵੀ ਨਹੀਂ ਮਿਲੇਗੀ ਇਹ ਨਵੀਂ ਨਵੀਂ ਖੇਡਾਂ ਜ ਜਿਵੇਂ ਪਬਜੀ ਫਰੀ ਫਾਇਰ ਆਦਿ ਇਹ ਸਭ ਕਦੇ ਵੀ ਬੱਚਿਆਂ ਲਈ ਸੁੱਖ ਨਹੀਂ ਦੇ ਸ ਦੇ ਸਕਦੀ ਇਹ ਉਨ੍ਹਾਂ ਨੂੰ ਬੁਰਾ ਅਸਰ ਹੀ ਕਰਨਗੀ ਅਤੇ ਉਨ੍ਹਾਂ ਦੇ ਸਰੀਰ ਦੀ ਤੰਦਰੁਸਤੀ ਘਟਾਉਣ ਗੀ